ਸੰਪਾਦਨ ਅਤੇ ਸੰਸ਼ੋਧਨਾ ਨੂੰ ਸੰਭਾਲ ਕਰਨ ਲਈ ਕੋਈ ਖ਼ਾਸ ਪ੍ਰਕਿਰਿਆ ਨਹੀਂ ਹੈ ਇਸ ਲਈ ਸੰਪਾਦਨ ਜਿਵੇਂ ਕਿ ਅਸੀਂ ਕੁਛ ਵੀ ਲਿਖਿਆ ਹੈ ਤਾਂ ਉਹਨੂੰ ਜਦੋਂ ਛਪਣ ਤੋਂ ਪਹਿਲਾਂ ਹੀ ਉਹਦੇ ਲਈ ਉਹਦੀ ਪਰਖ ਕਰਦੇ ਹੈ ਫਿਰ ਉਸ ਵਿੱਚ ਕੋਈ ਵੀ ਆਪਣੀ ਗਲਤੀ ਹੁੰਦੀ ਹੈ ਤਾਂ ਉਹਨੂੰ ਠੀਕ ਕਰਦੇ ਆ ਅਤੇ ਫਿਰ ਉਸਨੂੰ ਪ੍ਰਕਾਸ਼ਨ ਦੇ ਲਈ ਤਿਆਰ ਕਰਦੇ ਹੈ ਅਤੇ ਇਸ ਲਈ ਸੰਸ਼ੋਧਨ ਦਾ ਮਤਲਬ ਵੀ ਇਹ ਹੀ ਹੈ ਕਿ ਆਪਾਂ ਉਸ ਵਿੱਚ ਕੋਈ ਛਾਪਣ ਤੋਂ ਪਹਿਲਾਂ ਉਸਦੀ ਪਰਖ ਕਰਦੇ ਹੈਂ ਤੇ ਫਿਰ ਉਹਨਾਂ ਦੀ ਪਰਖ ਕਰਕੇ ਉਹਨੂੰ ਅਸੀਂ ਮ ਮ ਮਤਲਬ ਪ੍ਰਿੰਟ ਆਊਟ ਹੋਣ ਦੇ ਲਈ ਦਿੰਨੇ ਐਂ ਬਸ ਇਹ ਹੀ ਪਰਿਵਾਹ ਹੈ ਇਹਦਾ ਕੋਈ ਇਸ ਲਈ ਖ਼ਾਸ ਪ੍ਰਕਿਰਿਆ ਨਹੀਂ ਹੈ